ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੈ ਜੀ ਵਧੀਆ ਜੀ ਵਧੀਆ ਗੇਮ ਕਿੱਦਾਂ ਚੱਲਦੀ ਜੀ ਆਪਣੀ ਹੁਣ ਅੱਛਾ ਜੀ ਅੱਛਾ ਚਲੋ ਵਧੀਆ ਜੀ ਵਧੀਆ ਵਧੀਆ ਹੀ ਚੱਲਣੀ ਚਾਹੀਦੀ ਹੈ ਪ੍ਰਮਾਤਮਾ ਦੀ ਕ੍ਰਿਪਾ ਨਾਲ਼ ਭਾਅ ਜੀ ਮੈਂ ਵੀ ਨਾ ਨਵਾਂ ਨਵਾਂ ਕਬੱਡੀ ਖੇਡਣ ਲੱਗਿਆ ਸੀ ਮੈਂ ਸੋਚਿਆ ਵੀ ਕੋਈ ਚਲੋ ਆਹ ਪ੍ਰੋਫੈਸ਼ਨ ਚੁਣਨਾ ਆਪਾਂ ਨੇ ਕੋਈ ਵਧੀਆ ਜੀ ਅਕੈਡਮੀ ਦੇਖ ਲਈਏ ਮੈਂ ਕਿਹਾ ਕੋਈ ਫਿਰ ਜੋਆਇੰਨ ਹੀ ਕਰ ਲਈਏ ਇੱਕ ਅੱਧੀ ਹਾਂਜੀ ਹਾਂਜੀ ਮੈਂ ਕਿਹਾ ਚਲੋ ਮੈਂ ਵੀ ਦੇਖ ਲਾ ਇੱਕ ਅੱਧੀ ਅਕੈਡਮੀ ਵੀ ਜਿਹੜੀ ਮੈਨੂੰ ਵਧੀਆ ਉਹ ਕੌਚਿੰਗ ਦਵੇ ਖਾਣ ਪੀਣ ਵੀ ਵਧੀਆ ਹੋਵੇ ਉੱਥੇ ਰਹਿਣ ਸਹਿਣ ਵਧੀਆ ਹੋਵੇ ਜ਼ਿਆਦਾ ਚਲੋ ਪੈਸੇ ਨਾ ਲੱਗਣ ਮੇਰੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਹੁਣ ਇੰਨੇ ਪੈਸੇ ਹੈ ਵੀ ਨੀ ਮੇਰੇ ਕੋਲ ਹਾਂਜੀ ਦੱਸੋ ਜੀ ਫਿਰ ਕੋਈ ਵਧੀਆ ਜੀ ਅਕੈਡਮੀ ਅੱਛਾ ਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਅਤੇ ਇਹਨਾਂ ਦੀ ਫ਼ੀਸ ਵਗੈਰਾ ਕਿੰਨੀ ਹੈ ਜੀ ਫਿਰ ਅੱਛਾ ਜੀ ਇਹ ਤਾਂ ਫਿਰ ਬਹੁਤ ਜ਼ਿਆਦਾ ਹੈ ਜੀ ਕੋਈ ਸਰਕਾਰੀ ਦੇਖੋ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਸੁਣਿਆ ਜੀ ਮੈਂ ਨਾਮ ਉਹਦਾ ਬਹੁਤ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਚਲੋ ਮੈਂ ਦੇਖਦਾ ਫਿਰ ਟਰਾਈ ਮਾਰਕੇ ਉੱਧਰ ਵੀ ਜੇ ਗੱਲ ਬਣ ਜਾਵੇ ਆਪਣੀ ਬਸ ਠੀਕ ਹੈ ਜੀ ਫਿਰ ਤਾਂ ਆਪਣੀ ਗੱਲ ਬਣਜੂਗੀ ਚਲੋ ਠੀਕ ਹੈ ਜੀ ਫਿਰ ਜੇ ਨੰਬਰ ਹੈਗਾ ਤਾਂ ਮੈਨੂੰ ਸੈਂਡ ਕਰ ਦਿਓ ਵੱਟਸਐਪ 'ਤੇ ਉਹਨਾਂ ਦਾ ਮੈਂ ਗੱਲ ਕਰਲੂਗਾ ਉਹਨਾਂ ਨਾਲ਼ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਓਕੇ ਜੀ